ਅੱਜ ਕੱਲ੍ਹ ਬੱਚੇ ਜ਼ਿਆਦਾਤਰ ਫ਼ੋਨ ਆਦਿ ਦੀ ਵਰਤੋਂ ਕਰਦੇ ਹਨ ਅਤੇ ਉਹਨਾਂ ਵਿੱਚ ਹੀ ਖੇਡਾਂ ਖੇਡਣੀਆਂ ਪਸੰਦ ਕਰਦੇ ਹਨ ਜ਼ਿਆਦਾਤਰ ਵੀਡੀਓ ਗੇਮਸ ਆਦਿ ਨੂੰ ਪਸੰਦ ਕਰਦੇ ਹਨ ਜਿਸ ਨਾਲ ਉਹਨਾਂ ਦੀ ਸਰੀਰਕ ਸੰਤੁਲਨ ਵਿੱਚ ਵੀ ਖ਼ਰਾਬੀ ਹੁੰਦੀ ਹੈ ਅਤੇ ਉਹਨਾਂ ਨੂੰ ਵਧਣ ਫੁੱਲਣ ਵਿੱਚ ਵੀ ਆਦਿ ਦੀ ਤੰਗੀ ਆਉਂਦੀ ਹੈ ਜਿਵੇਂ ਕਿ ਬੱਚੇ ਅੱਜ ਕੱਲ੍ਹ ਦੀਆਂ ਨਵੀਆਂ ਖੇਡਾਂ ਨੂੰ ਪਸੰਦ ਕਰਦੇ ਹਨ ਉਹ ਜ਼ਿਆਦਾਤਰ ਫ਼ੋਨ ਆਦਿ ਦੀ ਵਰਤੋਂ ਕਰਕੇ ਹੀ ਆਪਣਾ ਟਾਈਮ ਪਾਸ ਕਰਦੇ ਹਨ ਜੇ ਆਪਾਂ ਗੱਲ ਕਰੀਏ ਪੁਰਾਣੀਆਂ ਗੇਮਾਂ ਦੀ ਤਾਂ ਉਸ ਨਾਲ ਸਰੀਰਕ ਸੰਤੁਲਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਹਾਈਟ ਆਦਿ ਵਧਣ ਫੁੱਲਣ ਵਿੱਚ ਵੀ ਕਾਫ਼ੀ ਉਹ ਯੋਗਦਾਨ ਪਾਉਂਦੀਆਂ ਸਨ ਜਿਵੇਂ ਕਿ ਆਪਾਂ ਪੁਰਾਣੀਆਂ ਗੇਮਾਂ ਦੀ ਗੱਲ ਕਰੀਏ ਜਿਵੇਂ ਕਿ ਫੁੱਟਬਾਲ ਹਾਕੀ ਆਦਿ ਪ ਪਿਛਲੇ ਬੱਚੇ ਖੇਡਦੇ ਹੁੰਦੇ ਸੀ ਪਰ ਅੱਜ ਕੱਲ੍ਹ ਦੇ ਬੱਚੇ ਨਵੀਆਂ ਖੇਡਾਂ ਨੂੰ ਹੀ ਜ਼ਿਆਦਾਤਰ ਮਹੱਤਵਪੂਰਨ ਮੰਨਦੇ ਹਨ ਜਿਵੇਂ ਕਿ ਚੈਸ ਕੈਰਮ ਬੋਰਡ ਆਦਿ ਨੂੰ ਖੇਡਣਾ ਹੀ ਪਸੰਦ ਕਰਦੇ ਹਨ ਮਿੱਟੀ ਘੱਟੇ ਤੋਂ ਆਦਿ ਤੋਂ ਦੂਰ ਰਹਿਣਾ ਹੀ ਜ਼ਿਆਦਾਤਰ ਪਸੰਦ ਕਰਦੇ ਹਨ ਜਿਸ ਨਾਲ ਉਹਨਾਂ ਦੇ ਸਰੀਰਕ ਪ ਸਰੀਰਕ ਪ੍ਰੋਬਲਮਸ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ ਜੇਕਰ ਬੱਚੇ ਜ਼ਿਆਦਾਤਰ ਪੁਰਾਣੀਆਂ ਗੇਮਾਂ ਨੂੰ ਖੇਡਣ ਤਾਂ ਉਹ ਕਾਫ਼ੀ ਉਹਨਾਂ ਲਈ ਵਧੀਆ ਰਹਿਣ ਰਹਿੰਦੀਆਂ ਹਨ